ਪੰਜਾਬ ਵਿੱਚ ਯੂਨੀਵਰਸਿਟੀਆਂ ਅਤੇ ਕੋਲਜਾਂ ਲਈ ਦਾਖਲਾ ਪ੍ਰਕਿਰਿਆ ਇਹ ਹਨ ਲੋੜਾਂ ਇਹ ਹਨ ਕਿ ਜਦੋਂ ਮੈਂ ਮੈਂ ਖੁਦ ਜਦੋਂ ਛੋਟਾ ਹੁੰਦਾ ਸੀ ਮੀਨਿੰਗ ਕਿ ਜਦੋਂ ਮੈਂ ਪਲੱਸ ਟੂ ਤੋਂ ਪਾਰ ਕੀਤੀ ਸੀ ਉਸ ਤੋਂ ਬਾਅਦ ਮੈਨੂੰ ਖੁਦ ਮੈਂ ਜਦੋਂ ਕੋਲਜ ਵਿੱਚ ਦਾਖਲਾ ਲੈਣਾ ਸੀ ਤਾਂ ਖੁਦ ਉਹਨਾਂ ਨੇ ਮੈਂ ਜਦੋਂ ਕੋਲਜ ਵਿੱਚ ਦਾਖਲਾ ਲੈਣ ਗਿਆ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਮੇਰੇ ਕੋਲ ਜੇਈ ਮੇਨ ਬਾਰੇ ਪੁੱਛਿਆ ਕਿ ਤੁਸੀਂ ਟੈਸਟ ਦਿੱਤਾ ਹੈ ਕਿ ਨਹੀਂ ਦਿੱਤਾ ਫਿਰ ਮੈਂ ਕਿਹਾ ਮੈਂ ਦਿੱਤਾ ਹੈ ਅਤੇ ਫਿਰ ਮੈਂ ਉਹਨਾਂ ਨੇ ਫਿਰ ਮੇਰੇ ਕੋਲੋਂ ਪਲੱਸ ਟੂ ਦੇ ਨੰਬਰ ਪੁੱਛੇ ਜਿਹਦੇ ਜਿਹੜੇ ਕਿ ਮੇਰੇ ਬਹੁਤ ਵਧੀਆ ਆਏ ਸਨ ਅਤੇ ਮੈਂ ਮੇਰੇ ਮੈਨੂੰ ਸਕੋਲਰਸ਼ਿਪ ਮਿਲੀ ਉਹਨਾਂ ਨੇ ਮੈਨੂੰ ਗੋਵਮੈਂਟ ਸਕੂਲ ਵਾਲਿਆਂ ਨੇ ਸਕੋਲਰਸ਼ਿਪ ਦਿੱਤੀ ਅਤੇ ਸਭ ਕੁਛ ਕੀਤਾ ਅਤੇ ਮੇਰੀਆਂ ਫ ਫੈਸਿਲਿਟੀਜ਼ ਦਿੱਤੀਆਂ ਕਿ ਸਭ ਕੁਛ ਤੁਹਾਨੂੰ ਸਭ ਕੁਛ ਪ੍ਰੋਵਾਈਡ ਕੀਤਾ ਜਾਵੇਗਾ ਕਿ ਤੁਹਾਨੂੰ ਲਾਈਬ੍ਰੇਰੀ ਵਿੱਚ ਬੁੱਕਸ ਵੀ ਦਿੱਤੀਆਂ ਜਾਣਗੀਆਂ ਸਭ ਕੁੱਝ ਦਿੱਤਾ ਜਾਵੇਗਾ ਇਸ ਲਈ ਮੈਨੂੰ ਬਹੁਤ ਸਾਰੀਆਂ ਮੈਂ ਬਹੁਤ ਸਾਰਾ ਖੁ ਮੈਂ ਉਦੋਂ ਬਹੁਤ ਖੁਸ਼ ਸੀ ਕਿ ਜਦੋਂ ਮੈਨੂੰ ਸਕੋਲਰਸ਼ਿਪ ਮਿਲੀ ਅਤੇ ਮੈਂ ਇਹ ਅਤੇ ਫਿਰ ਉਹਨਾਂ ਨੇ ਮੈਨੂੰ ਸਕੋਲਰਸ਼ਿਪ ਦਿੱਤੀ ਅਤੇ ਕਿਹਾ ਕਿ ਅੱਜ ਤੋਂ ਬਾਅਦ ਵੀ ਇਸ ਤਰ੍ਹਾਂ ਹੀ ਕਰਨਾ ਹੈ ਕਿਤੇ ਫਿਰ ਸਕੋਲਰਸ਼ਿਪ ਤੋਂ ਬਾਅਦ ਮੈਂ ਫਿਰ ਉਹਨਾਂ ਨੇ ਮੈਨੂੰ ਕੋਲਜ ਲੈਣ ਲਈ ਕਿਹਾ ਕਿ ਤੁਹਾ ਇੱਥੇ ਬਹੁਤ ਸਪੋਰਟਸ ਵੀ ਹਨ ਖੇਡਾਂ ਵੀ ਹਨ ਜੋ ਕਿ ਤੁਸੀਂ ਪਾਟੀ ਹਿੱਸਾ ਲੈ ਸਕਦੇ ਹੋ ਅਤੇ ਅਸੀਂ ਖੇਡ ਸਕਦੇ ਹੋ ਅਤੇ ਹੋਰ ਅਤੇ ਮੈਨੂੰ ਜਦੋਂ ਮੈਂ ਜੇਈ ਦਾ ਮੇਨ ਟੈਸਟ ਦਿੱਤਾ ਸੀ ਅਤੇ ਉਹਨਾਂ ਨੇ ਮੈਨੂੰ ਕਿਹਾ ਸੀ ਤੁਹਾਡੇ ਕਿੰਨੇ ਨੰਬਰ ਆਏ ਅਤੇ ਮੈਂ ਕਿਹਾ ਬਹੁਤ ਵਧੀਆ ਨੰਬਰ ਹਨ ਇਸ ਲਈ ਮੈਨੂੰ ਉਹਨਾਂ ਨੇ ਵਧੀਆ ਤੋਂ ਵਧੀਆ ਸਕੋਲਰਸ਼ਿਪ ਦਿੱਤੀ ਕਿ ਜੋ ਕਿ ਮੈਂ ਅੱਗੇ ਵੱਧ ਸਕਾਂ ਅਤੇ ਆਪਣਾ ਮੁਕਾਮ ਹਾਸਿਲ ਕਰ ਸਕਾਂ ਇਸ ਲਈ ਉਹਨਾਂ ਨੇ ਮੈਨੂੰ ਸਕੋਲਰਸ਼ਿਪ ਵਧੀਆ ਤੋਂ ਵਧੀਆ ਦਿੱਤੀ ਸੀ